ਸਤਿ ਸ਼੍ਰੀ ਅਕਾਲ ਜੀ ਤੁਸੀਂ ਚੰਨੀ ਦੀ ਹੱਟੀ ਤੋਂ ਗੱਲ ਕਰ ਰਹੇ ਹਾਂ ਮੈਂ ਇੱਕ ਸੂਟ ਦੇਖਿਆ ਸੀ ਜਿਹੜਾ ਮੀਸ਼ੋ ਐਪ ਹੈ ਉਹਦੇ ਪਰ ਕਿ ਉਹਦੇ ਪਰ ਛੂਟ ਲੱਗੀ ਹੋਈ ਸੀ ਅਤੇ ਉਹ ਸੂਟ ਬਹੁਤ ਸੋਹਣਾ ਸੀ ਅਤੇ ਮੈਨੂੰ ਉਹ ਹੁਣ ਹੀ ਮਤਲਬ ਦੋ ਤਿੰਨ ਦਿਨ ਤੱਕ ਚਾਹੀਦਾ ਹੀ ਹੈ ਮੈਂ ਵਿਆਹ 'ਤੇ ਪਾਉਣਾ ਹੈ ਅਤੇ ਮੈਂ ਕਿਆ ਮੈਨੂੰ ਹੁਣ ਹੀ ਮਤਲਬ ਦੋ ਤਿੰਨ ਦਿਨ ਤੱਕ ਉਹ ਤੁਸੀਂ ਲਿਆ ਮਤਲਬ ਮੰਗਵਾ ਸਕਦੇ ਹਾਂ ਉਹ ਉਹ ਛੂਟ ਲੱਗੀ ਵੀ ਹੋਵੇ ਉਹਦੇ ਪਰ ਮੈਨੂੰ ਉਹ ਸੇਮ ਸੂਟ ਚਾਹੀਦਾ ਹੈ ਮੈਂ ਤੁਹਾਨੂੰ ਉਹਦੇ ਪਰ ਉਹਨੂੰ ਵਟ ਉਹ ਸੂਟ ਦੀ ਫੋਟੋ ਤੁਹਾਨੂੰ ਵਟਸਐੱਪ ਕਰ ਦਿਊਂਗੀ ਤੁਸੀਂ ਮੈਨੂੰ ਮੰਗਵਾ ਕੇ ਰੱਖ ਸਕਦੇ ਹਾਂ ਮੈਨੂੰ ਬਾਅਦ ਵਿੱਚ ਮੈਨੂੰ ਮੈਸੇਜ ਕਰਕੇ ਦੱਸ ਦਿਉ